ਹਾਂਜੀ ਸਤਿ ਸ਼੍ਰੀ ਅਕਾਲ ਅੱਛਾ ਅੱਛਾ ਅੱਛਾ ਅੱਛਾ ਅੱਛਾ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਕੀ ਕੀ ਸੇਵਾ ਕਰ ਸਕਦੇ ਤੁਹਾਡੀ ਹਾਂਜੀ ਦੱਸੋ ਹਾਂਜੀ ਹਾਂਜੀ ਇੱਥੇ ਮੈਡੀਕਲ ਸਰਵਿਸ ਬਹੁਤ ਵਧੀਆ ਗੁਰਦਾਸਪੁਰ ਦੇ ਵਿੱਚ ਬੜੀਆਂ ਸੁਵਿਧਾ ਨੇ ਅਤੇ ਸਰਕਾਰੀ ਹੋਸਪੀਟਲ ਵੀ ਹੈਗਾ ਆ ਉੱਥੇ ਵੀ ਫਰੀ ਇਲਾਜ ਹੁੰਦਾ ਆ ਦਵਾਈਆਂ ਵੀ ਮਿਲਦੀਆਂ ਹਰ ਇੱਕ ਤਰ੍ਹਾਂ ਦੀਆਂ ਇੱਕ ਇੱਥੇ ਲਾਗੇ ਸਾਡੇ ਬੱਬਰੀ ਹੋਸਪਿਟਲ ਆ ਅਤੇ ਜਿੱਥੇ ਸਿਰਫ ਦਸ ਰੁਪਏ ਦੀ ਪਰਚੀ ਕੱਟਦੇ ਆ ਅਤੇ ਚੌਵੀ ਘੰਟੇ ਮਤਲਬ ਉਪਲਬਧ ਰਹਿੰਦੇ ਨੇ ਡਾਕਟਰ ਉੱਥੇ ਜਦੋਂ ਮਰਜ਼ੀ ਤੁਸੀਂ ਜਾ ਸਕਦੇ ਹੋ ਉੱਥੇ ਅਤੇ ਜ਼ਰੂਰਤ ਪਈ 'ਤੇ

ਹਾਂਜੀ ਹਾਂਜੀ ਹਾਂਜੀ ਐਮਬੂਲੈਂਸ ਸਰਵਿਸ ਵੀ ਹੈਗੀ ਉਹਨਾਂ ਦੀ ਜਦੋਂ ਮਰਜ਼ੀ ਤੁਸੀਂ ਉਹਨਾਂ ਦਾ ਫੋਨ ਨੰਬਰ ਕੋਈ ਨਾ ਮੈਂ ਦੇ ਦੂੰਗੀ ਤੁਹਾਨੂੰ ਤੁਸੀਂ ਫੋਨ ਕਰੋ ਅਤੇ ਐਮਬੂਲੈਂਸ ਪਹੁੰਚ ਜਾਂਦੀ ਹੈ ਮਿੰਟੋ ਮਿੰਟ ਹੀ ਹਾਂਜੀ ਹਾਂਜੀ

ਨਾ ਹਾਂ ਨਹੀਂ ਨਹੀਂ ਬਹੁਤ ਵਧੀਆ ਡਾਕਟਰ ਨੇ ਵਧੀਆ ਤਰੀਕੇ ਨਾਲ ਇਲਾਜ ਕਰਦੇ ਨੇ ਕੋਈ ਚੱਕਰ ਨਹੀਂ ਇਹੋ ਜਿਹਾ ਅਤੇ ਬੱਬਰੀ ਜਿਹੜਾ ਹੋਸਪੀਟਲ ਆ ਉਹ ਤਾਂ ਇੱਕ ਹਿਸਾਬ ਦਾ ਫ੍ਰੀ ਆ ਦਸ ਰੁਪਏ ਦੀ ਬਸ ਪਰਚੀ ਕੱਟਦੇ ਨੇ ਅਤੇ ਡਾਕਟਰ ਵੀ ਚੌਵੀ ਘੰਟੇ ਉੱਥੇ ਮੌਜੂਦ ਹੁੰਦੇ ਨੇ ਜਦੋਂ ਮਰਜ਼ੀ ਜਾਓ ਤੁਸੀਂ ਐਮਬੂਲੈਂਸ ਦਾ ਵੀ ਅਰੇਂਜਮੈਂਟ ਹੈਗਾ ਹੋਰ ਵੀ ਇੱਥੇ ਕਾਫੀ ਹੋਸਪੀਟਲ ਨੇ ਅਲੱਗ ਅਲੱਗ ਤਰ੍ਹਾਂ ਦੇ ਕਿਸੇ ਤਰ੍ਹਾਂ ਦਾ ਵੀ ਇਲਾਜ ਕਰਵਾਉਣਾ ਹੋਵੇ ਉਹ ਇੱਧਰ ਹੀ ਪੈਂਦਾ ਬੱਬਰੀ ਰੋਡ 'ਤੇ ਇੱਧਰ ਲਾਗੇ ਹੀ ਪੈਂਦਾ ਵਾ ਇੱਧਰ ਹਨੂੰਮਾਨ ਚੌਂਕ ਵਾਲੀ ਸਾਈਡ 'ਤੇ ਹਾਂਜੀ ਹਾਂਜੀ ਕੋਈ ਗੱਲ ਨਹੀਂ ਤੁਹਾਨੂੰ ਕੋਈ ਜ਼ਰੂਰਤ ਪਵੇਗੀ ਤਾਂ ਤੁਸੀਂ ਆਹ ਮੇਰਾ ਨੰਬਰ ਤੁਹਾਡੇ ਕੋਲ ਹੈਗਾ ਆ ਕੌਲ ਕਰ ਲਿਓ ਜਦੋਂ ਵੀ ਲੋੜ ਪੈਂਦੀ ਆ ਅਤੇ ਮੈਂ ਦੱਸ ਦੂੰਗੀ ਹੋਰ ਵੀ ਕੋਈ ਜਾਣਕਾਰੀ ਲੈਣੀ ਹੋਏ ਤਾਂ ਮੈਂ ਦੱਸ ਦੂੰਗੀ ਕੋਈ ਚੱਕਰ ਨਹੀਂ ਹਾਂ ਹਾਂਜੀ ਹਾਂਜੀ ਠੀਕ ਠੀਕ